ਹੈਲੋ ਹਾਂ ਪਰਮ ਕੀ ਹਾਲ ਹੈ ਓ ਹੋ ਬਸ ਇਸ ਤਰ੍ਹਾਂ ਹੀ ਹੁਣ ਤੈਨੂੰ ਪਤਾ ਹੈ ਬਾਅਦ ਵਿੱਚ ਕਿਸ ਤਰ੍ਹਾਂ ਹੁੰਦੀ ਗੱਲ ਬਿਜੀ ਰਹੀਦਾ ਹੋਰ ਦੱਸ ਤੂੰ ਅੱਛਾ ਯਾਰ ਮੈਂ ਨਾ ਕੁਛ ਸੋਚਣ ਦੀ ਸੀ ਮੈਂ ਸੋਚ ਰਹੀ ਸੀ ਆਪਾਂ ਕੋਈ ਸਟਾਰਟਅਪ ਕਰਦੇ ਹਾਂ ਦੇਖ ਮੇਰੀ ਵੀ ਬੀਟੈਕ ਹੋ ਗਈ ਆ ਤੇਰੀ ਵੀ ਬੀਟੈਕ ਹੋ ਗਈ ਆ ਅਤੇ ਮੈਂ ਸੋਚਦੀ ਹਾਂ ਕਿ ਆਪਾਂ ਘਰ ਘਰ ਜਾ ਕੇ ਨਾ ਬੱਚਿਆਂ ਨੂੰ ਟਿਊਸ਼ਨ ਬਾਰੇ ਟਿਊਸ਼ਨ ਸੈਂਟਰ ਬਾਰੇ ਦੱਸਦੇ ਕਿ ਆਪਾਂ ਟਿਊਸ਼ਨ ਦੇਵਾਂਗੇ ਲੋਕੀ ਤਾਂ ਸਭ ਟਿਊਸ਼ਨ 'ਤੇ ਬੁਲਾਉਂਦੇ ਤਾਂ ਹੈਗੇ ਪਰ ਆਪਾਂ ਘਰ ਘਰ ਜਾ ਕੇ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਹਾਂ ਹਾਂ ਅਤੇ ਚੱਲ ਠੀਕ ਆ ਤੂੰ ਮੈਨੂੰ ਨਾ ਮਿਲੀ ਘਰ ਦੇ ਵਿੱਚ ਆਣ ਕੇ ਅਤੇ ਆਪਾਂ ਸ਼ਾਮੀ ਨਾਲੇ ਚਾਹ ਪਾਣੀ ਪੀਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਨਾਲੇ ਇਹਦੇ ਬਾਰੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਆਪਣਾ ਜਿਹੜਾ ਸਟਾਰਟਅਪ ਆ ਉਹ ਸ਼ੁਰੂ ਕਰਨਾ ਹੈ ਅਤੇ ਕਿਸ ਤਰ੍ਹਾਂ ਉਹਨੂੰ ਪ੍ਰੋਵਾਈਡ ਕਰਨਾ ਆ ਹੈ ਨਾ ਹਾਂ ਹੋਰ ਤੂੰ ਦੱਸ ਕਿਸ ਤਰ੍ਹਾਂ ਸਭ ਬਾਕੀ ਅਤੇ ਇਹਦੇ ਉੱਤੇ ਨਾ ਤੂੰ ਵੀ ਜੋ ਵੀ ਤੇਰੇ ਵੀ ਆਈਡੀਆ ਹੋਣਗੇ ਨਾ ਉਹ ਤੂੰ ਸਭ ਲੈ ਕ ਦੇਖ ਲੀ ਅਤੇ ਆਪਾਂ ਦੋਵੇਂ ਉਹ ਰਲ ਕੇ ਅਤੇ ਕਰ ਲਾਂਗੇ ਸ਼ਾਮੀ ਚਲ ਠੀਕ ਆ ਫਿਰ ਬਾਏ ਥੈਂਕ ਯੂ ਹਾਂ ਥੈਂਕ ਯੂ ਓਕੇ ਬਾਏ ਬਾਏ ਥੈਂਕ ਯੂ